ਮੇਰੇ ਸਾਰੇ ਦੋਸਤ ਅਤੇ ਮਿਲਣਸਾਰ ਚੰਗੇ ਕੋਲਜਾਂ ਤੋਂ ਡਿਗਰੀ ਪ੍ਰਾਪ ਮਾਨਤਾ ਪ੍ਰਾਪਤ ਹਨ ਅਤੇ ਉਹ ਪ ਚੰਗੀ ਤਰ੍ਹਾਂ ਪੜ੍ਹੇ ਲਿਖੇ ਹੋਏ ਹਨ ਪਰ ਇੱਕ ਇਹ ਅਜਿਹਾ ਇਨਸਾਨ ਜੋ ਕਿ ਮੇਰੇ ਦਿਲ ਵਿੱਚ ਖਾਸ ਜਗ੍ਹਾ ਰੱਖਦਾ ਹੈ ਜੋ ਕਿ ਜਿਸ ਨੇ ਕਿ ਪੀ ਐੱਚ ਡੀ ਕੀਤੀ ਸੀ ਅਤੇ ਹੁਣ ਉਹ ਮਾਤਾ ਗੁਜਰੀ ਕੋਲਜ ਦੇ ਵਿੱਚ ਇੱਕ ਅਧਿਆਪਕ ਦੇ ਪੱਖੋਂ ਨੌਕਰੀ ਨਿਭਾ ਰਿਹਾ ਸੀ ਜਿਸਦਾ ਨਾਮ ਅੰਮ੍ਰਿਤਪਾਲ ਸਿੰਘ ਸੀ ਅਤੇ ਪਿਛਲੇ ਹੀ ਕੁਛ ਦਿਨਾਂ ਵਿੱਚ ਪਿਛਲੇ ਸਾਲ ਉਸਤੀ ਉਸਦੀ ਮੌਤ ਹੋ ਚੁੱਕੀ ਸੀ ਜਿਸ ਦੀ ਕਿ ਵਜ੍ਹਾ ਹਾਟ ਅਟੈਕ ਸੀ ਮੇਰੇ ਅਨੁਸਾਰ ਉਸਨਾ ਉਹਨਾਂ ਨੇ ਆਪਣੇ ਲਈ ਤਾਂ ਕੁਛ ਚੰਗਾ ਨਹੀਂ ਕੀਤਾ ਪਰ ਕੋਲਜ ਅਤੇ ਉੱਥੇ ਦੇ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਚੰਗਾ ਕੀਤਾ ਸੀ ਅਤੇ ਉਹ ਅਕਸਰ ਜੋ ਬੱਚੇ ਆਪਣੀਆਂ ਫੀਸਾਂ ਨਹੀਂ ਭਰ ਸਕਦੇ ਸਨ ਪ੍ਰਿੰਸੀਪਲ ਸਰ ਨਾਲ ਗੱਲ ਕਰਕੇ ਉਹਨਾਂ ਦੀਆਂ ਫੀਸਾਂ ਘਟਵਾ ਦਿੰਦੇ ਸਨ ਅਤੇ ਕਈ ਵਾਰ ਤਾਂ ਉਹ ਆਪਣੇ ਕੋਲੋਂ ਪੈਸੇ ਪਾ ਕੇ ਵੀ ਵਿਦਿਆਰਥੀਆਂ ਦੀ ਮਦਦ ਕਰਦੇ ਸਨ